ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਪਹਿਲਾਂ ਹੈ ਨਾ ਟੋਪਿਕ 'ਤੇ ਗੱਲ ਕਰਕੇ ਹਟੇ ਹਾਂ ਵੀ ਬਾਗਬਾਨੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਤਾਂ ਜਿਹੜੀ ਗਰਮੀ ਦੇ ਮੌਸਮ ਵਿੱਚ ਪੌਦਿਆਂ ਦੀ ਸੰਭਾਲ ਕਰਨੀ ਹੋ ਹੈ ਨਾ ਉਹ ਬੜੀ ਔਖੀ ਹੋ ਜਾਂਦੀ ਹੈ ਗਰਮੀ ਦੇ ਵਿੱਚ ਅੱਜ ਕੱਲ੍ਹ ਮੌਸਮ ਆ ਜਿਹੜਾ ਤੁਹਾਨੂੰ ਪਤਾ ਵੀ ਪੰਤਾਲੀ ਡਿਗਰੀ 'ਤੇ ਪਹੁੰਚਿਆ ਪਿਆ ਬਹੁਤ